ਸਿਲਾਈ ਸੂਟਾਂ ਦੀ ਵੈਸੇ ਤਾਂ ਰੇਟ ਸਭ ਦੇ ਵੱਖੋ ਵੱਖਰੇ ਨੇ ਸਿੰਪਲ ਸੂਟ ਦਾ ਮੈਂ ਢਾਈ ਸੌ ਰੁਪਈਆ ਲੈਂਦੀ ਹਾਂ ਜੇ ਲਾਈਨਿੰਗ ਵਗੈਰਾ ਲਗਾ ਕੇ ਸਿਊਣਾ ਹੁੰਦਾ ਤਾਂ ਅਸੀਂ ਉਹਦਾ ਸਾਢੇ ਪੰਜ ਸੌ ਰੁਪਇਆ ਲੈਂਦੇ ਹਾਂ ਜੇ ਕੋਈ ਕਹਿ ਦਵੇ ਵੀ ਪਲਾਜੋ ਪੈਂਟ ਵਗੈਰਾ ਸਵਾਉਣੀ ਆ ਤਾਂ ਚਾਰ ਸੌ ਰੁਪਈਆ ਵੀ ਲੈ ਲਈਦਾ ਯਾਨੀ ਕਿ ਜਿਵੇਂ ਕੋਈ ਕਢਾਈ ਵਗੈਰਾ ਦਾ ਹੋਵੇ ਸੂਟ ਤਾਂ ਉਹਦੀ ਥੋੜ੍ਹੀ ਜਿਹੀ ਉਸਦੇ ਅਕੋਰਡਿੰਗ ਉਨੇ ਹੀ ਪੈਸੇ ਜ਼ਿਆਦਾ ਲੈ ਲਏ ਨੇ ਸ਼ਰਾਰਾ ਵਗੈਰਾ ਬਣਾਉਣਾ ਹੋਵੇ ਤਾਂ ਹਜ਼ਾਰ ਰੁਪਇਆ ਵੀ ਲੈ ਲਈਦਾ ਕੋਈ ਲਹਿੰਗਾ ਚੋਲੀ ਵਗੈਰਾ ਬਰਾਈਡਰ ਕੋਈ ਡਰੈਸ ਅਲੱਗ ਤੋਂ ਬਣਾਉਣੀ ਹੋਵੇ ਤਾਂ ਉਹਦੀ ਮੈਂ ਕੀਮਤ ਤਕਰੀਬਨ ਬਾਰਾਂ ਸੌ ਜਾਂ ਚੌਦਾਂ ਸੌ ਵੀ ਲੈ ਲੈਂਦੀ ਹੁੰਦੀ ਹਾਂ ਯਾਨੀ ਹਰੇਕ ਕੱਪੜੇ ਦੀ ਆਪਣੇ ਸਿਲਾਈ ਉਹਨਾਂ ਦੇ ਅਕੋਰਡਿੰਗ ਵੱਖ ਵੱਖ ਹੁੰਦੀ ਆ ਅਤੇ ਜੇ ਕਿਸੇ ਨੂੰ ਐਮਰਜੈਂਸੀ ਬਹੁਤ ਕਾਹਲੀ ਹੁੰਦੀ ਹੈ ਵੀ ਸਾਨੂੰ ਇੱਕ ਦਿਨ ਦੇ ਵਿੱਚ ਬਣਾ ਕੇ ਦਿਓ ਤਾਂ ਫਿਰ ਮੈਂ ਉਹ ਸੂਟ ਦੀ ਸਿਲਾਈ ਕਈ ਵਾਰ ਡਬਲ ਵੀ ਲੈ ਲਈ ਦੀ ਆ ਅਤੇ ਗਾਹਕ ਵੀ ਸਾਨੂੰ ਹੱਸ ਕੇ ਉਹ ਸਿਲਾਈ ਦੇ ਦਿੰਦੇ ਨੇ ਕਿਉਂਕਿ ਅਸੀਂ ਟਾਈਮ 'ਤੇ ਉਹਨਾਂ ਨੂੰ ਸੂਟ ਦੇ ਦਿੰਦੇ ਹਾਂ ਵਧੀਆ ਤਿਆਰ ਕਰਕੇ ਦੇਈਦਾ ਆਲੇ ਦੁਆਲੇ ਸਾਰੇ ਸੂਟ ਸਿਲਾਈ ਵਗੈਰਾ ਸੂਟ ਸਾਡੇ ਕੋਲੋਂ ਹੀ ਕਰਾਉਂਦੇ ਨੇ